ਹੈਲੋ ਸਤਿ ਸ਼੍ਰੀ ਅਕਾਲ ਮੈਡਮ ਮੈਡਮ ਇਸ਼ਪ੍ਰੀਤ ਬੋਲ ਰਹੇ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਮੈਡਮ ਮੈਂ ਨਾ ਇੱਕ ਸਟੂਡੈਂਟ ਬੋਲ ਰਹੀ ਹਾਂ ਮੈਂ ਨਾ ਮੇਰੇ ਫਾਦਰ ਦੀ ਟਰਾਂਸਫਰ ਹੋਈ ਹੈ ਜੀ ਫਤਿਹਗੜ੍ਹ ਸਾਹਿਬ ਮੈਂ ਨਾ ਬੀ ਟੈਕ ਕੀਤੀ ਹੋਈ ਹੈ ਜੀ ਅਤੇ ਐੱਮ ਟੈਕ ਕੀਤੀ ਹੋਈ ਆ ਮੈਂ ਹੁਣ ਇੱਥੇ ਫਤਿਹਗੜ੍ਹ ਸਾਹਿਬ ਦੇ ਅੰਦਰ ਜੋਬ ਚਾਹੁੰਦੀ ਹਾਂ ਕਿ ਇੱਥੇ ਮੈਂ ਥੋਤੋਂ ਪਤਾ ਕਰਨਾ ਚਾਹੁੰਦੀ ਹਾਂ ਵੀ ਇੱਥੇ ਫਤਿਹਗੜ੍ਹ ਸਾਹਿਬ 'ਚ ਕੀ ਜੋਬ ਓਪਰਚੁਨਿਟੀ ਹੈਗੀ ਆ ਜਿਹੜੀ ਮੈਂ ਜੋਬ ਕਿਸ ਜੋਬ ਲਈ ਅਪਲਾਈ ਕਰ ਸਕਦੀ ਹਾਂ ਮੇਰਾ ਨਾਮ ਮੈਡਮ ਮਨਪ੍ਰੀਤ ਕੌਰ ਹੈ ਜੀ ਮੈਡਮ ਮੈਂ ਬੀ ਟੈਕ ਸਿਵਲ ਇੰਜਨੀਅਰਿੰਗ 'ਚ ਕਰੀ ਹੋਈ ਹੈ ਜੀ ਅਤੇ ਐੱਮ ਟੈਕ ਮੈਂ ਸੋਇਲ ਐਂਡ ਫਾਊਂਡੇਸ਼ਨ ਇੰਜਨੀਅਰਿੰਗ 'ਚ ਕੀਤੀ ਹੋਈ ਹੈ ਜੀ ਦੋ ਹਜ਼ਾਰ ਗਿਆਰਾਂ 'ਚ ਮੈਡਮ ਮੈਂ ਨਾ ਪਹਿਲਾਂ ਤਾਂ ਔਫਿਸ 'ਚ ਸੀਗੀ ਜੀ ਕਿਸੇ ਪ੍ਰਾਈਵੇਟ ਔਫਿਸ ਸੀਗੀ ਉੱਥੇ ਮੈਂ ਸਿਵਲ ਦਾ ਕੰਮ ਕਰਦੀ ਸੀ ਐਸਟੀਮੇਟ ਦਾ ਅਤੇ ਫੇਰ ਮੈਂ ਦੋ ਕੁ ਸਾਲ ਟੀਚਿੰਗ 'ਚ ਵੀ ਕੀਤਾ ਹੈ ਕੰਮ ਟੀਚਿੰਗ ਲਾਈਨ ' ਚ ਵੀ ਰਹੀ ਆ ਮੈਂ ਸ ਅ ਬੀ ਟੈਕ ਦੇ ਸਟੂਡੈਂਟਸ ਪੜ੍ਹਾਏ ਨੇ ਜੀ ਅੱਛਾ ਜੀ ਹਾਂਜੀ ਮੈਡਮ ਠੀਕ ਹੈ ਮੈਡਮ ਅੱਛਾ ਜੀ ਠੀਕ ਹੈ ਮੈਡਮ ਮੈਨੂੰ ਇਹ ਲੱਗਦਾ ਮੈਨੂੰ ਸੂਟ ਕਰਦੀ ਆ ਮੈਂ ਨਾ ਫਿਰ ਵਿਜ਼ਿਟ ਕਰਦੀ ਹਾਂ ਜੀ ਕੱਲ੍ਹ ਨੂੰ ਹੈ ਨਾ ਮੈਂ ਕੱਲ੍ਹ ਨੂੰ ਆ ਜਾਂਦੀ ਹਾਂ ਜੀ ਓਕੇ ਜੀ ਓਕੇ